ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਬਚਪਨ ਵਿੱਚ ਹੀ ਜੋ ਕਰਜ਼ੇ ਅਤੇ ਰਿਟਰ ਰਿਟਰਨਟ ਬਾਰੇ ਸਿਖਾਉਣਾ ਚਾਹੀਦਾ ਹੈ ਉਹਨਾਂ ਨੂੰ ਸਕੂਲਾਂ ਕਾਲਜਾਂ ਵਿੱਚ ਹੀ ਇਸ ਦੀ ਜਾਣਕਾਰੀ ਦੇ ਦਿੱਤੀ ਜਾਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਅਗਰ ਉਹਨਾਂ ਨੂੰ ਪਤਾ ਹੋਵੇਗਾ ਕਿ ਸਾਨੂੰ ਕਿਸ ਕਿਸ ਚ ਕਿਹੜੀ ਕਿਹੜੀ ਸਕਾਲਰਸ਼ਿਪ ਹੈ ਅਤੇ ਸਾਨੂੰ ਬੈਂਕ ਵਿੱਚੋਂ ਕਿਹੜੇ ਕਿਹੜੇ ਲੋਨ ਮਿਲ ਸਕਦੇ ਹਨ ਜਿਨ੍ਹਾਂ ਨਾਲ ਅਸੀਂ ਆਪਣੀ ਵਿੱਦਿਆ ਉੱਚ ਵਿੱਦਿਆ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਕਦੀ ਕਦੀ ਹੁੰਦਾ ਹੈ ਕਿ ਜਦੋਂ ਅਸੀਂ ਉਗ ਅੱਗੇ ਉੱਤੇ ਪੱਧਰ 'ਤੇ ਵੀ ਜਾਣਾ ਚਾਹੁੰਦੇ ਹਾਂ ਤੇ ਪਰ ਜਦੋਂ ਅਸੀਂ ਵੇਖਦੇ ਹਾਂ ਕਿ ਸਾਡੇ ਘਰਦਿਆਂ ਘਰ ਵਾਲਿਆਂ ਵਿੱਚ ਇੰਨੀ ਸ਼ਮਤਾ ਨਹੀਂ ਹੈ ਉਹ ਸਾਨੂੰ ਉੱਚ ਵਿੱਦਿਆ ਪ੍ਰਦਾਨ ਕਰ ਸਕਣ ਤਾਂ ਅਸੀਂ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਜੇ ਸਾਨੂੰ ਇਹਨਾਂ ਦੇ ਚੀਜ਼ਾਂ ਬਾਰੇ ਪਤਾ ਹੋਵੇ ਅਤੇ ਇਹ ਜਾਣਕਾਰੀ ਹੋਵੇ ਕਿ ਅਸੀਂ ਕਿਸ ਤਰ੍ਹਾਂ ਉੱਚ ਵਿੱਦਿਆ ਪ੍ਰਾਪਤ ਕਰ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਐਜੂਕੇਸ਼ਨਲ ਲੋਨ ਲੈ ਕੇ ਆਪਣੀ ਵਿੱਦਿਆ ਪੂਰੀ ਕਰ ਸਕਦੇ ਹਾਂ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਕੂਲਾਂ ਕਾਲਜਾਂ ਵਿੱਚ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਇਸ ਬਾਰੇ ਦ ਅ ਅਤੇ ਅਲੱਗ ਅਲੱਗ ਚੀਜ਼ਾਂ ਬਾਰੇ ਦੱਸਣਾ ਚਾਹੀਦਾ ਹੈ ਕਿ ਹੋਰ ਕਿਹੜੇ ਕਿਹੜੇ ਚੀਜ਼ਾਂ ਹੋਰ ਕਿਹੜੇ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਉਪਯੋਗ ਕਰਕੇ ਅਸੀਂ ਆਪਣੀ ਅ ਸਹੂਲਤਾਂ ਨੂੰ ਪੂਰਾ ਕਰ ਸਕਦੇ ਹਾਂ ਅਤੇ ਹੋਰ ਕਿਸ ਕਿਸ ਤਰ੍ਹਾਂ ਆਪਾਂ ਲੋਨ ਲੈ ਸਕਦੇ ਹਾਂ ਅਤੇ ਕਿਹੜੀਆਂ ਕਿਹੜੀਆਂ ਸਕੋਲਰਸ਼ਿੱਪਾਂ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਅਗਲੀ ਪੜ੍ਹਾਈ ਨੂੰ ਪੂਰਾ ਕਰ ਸਕਦੇ ਹਾਂ ਅਤੇ ਜੋ ਚਾਹੇ ਉਹ ਮੁਕਾਮ ਲੈ ਕੇ ਪੂਰਾ ਕਰ ਸਕਦੇ ਹਾਂ